ਹੁਣ ਤੱਕ ਜਿਹੜੀਆਂ ਤਸਵੀਰਾਂ ਮੈਂ ਖਿੱਚੀਆਂ ਨੇ ਉਹਨਾਂ ਦੇ ਵਿੱਚ ਜ਼ਿਆਦਾਤਰ ਮੈਂ ਨੇਚਰ ਬਾਰੇ ਹੀ ਕੈਪਚਰ ਕਰਦਾਂ ਜਿਹੜਾ ਕੁਦਰਤ ਹੈ ਕੁਦਰਤ ਤੋਂ ਵੱਡੀ ਕੋਈ ਚੀਜ਼ ਨਹੀਂ ਜਿਹੜੀਆਂ ਕੁਦਰਤੀ ਚੀਜ਼ਾਂ ਕੁਦਰਤੀ ਮਾਹੌਲ ਜਿੱਥੇ ਮੈਨੂੰ ਮਿਲ ਜਾਂਦਾ ਮੈਂ ਉੱਥੇ ਜਾ ਉਹੋ ਜਿਹੀਆਂ ਫੋਟੋਆਂ ਜਿਹੜੀਆਂ ਜ ਤਸਵੀਰਾਂ ਜ਼ਰੂਰ ਖਿੱਚਦਾਂ ਅਤੇ ਅੱਗੇ ਵੀ ਖਿੱਚਦਾ ਰਹਾਂਗਾ